ਪਹਿਲਾਂ ਮੈਨੂੰ ਕਲਾ ਦੇ ਵਿੱਚ ਕੋਈ ਵੀ ਇਟਰਸਟ ਨਹੀਂ ਸੀ ਪਰ ਜਦੋਂ ਇੱਕ ਦਿਨ ਮੈਂ ਫੋਨ ਵਿੱਚ ਵੀਡੀਓ ਵੇਖ ਰਹੀ ਸੀ ਤਾਂ ਉੱਥੇ ਇੱਕ ਵੀਡੀਓ ਆਈ ਜਿਸ ਵਿੱਚ ਬਹੁਤ ਹੀ ਸੁੰਦਰ ਕਲਾ ਬਣਾਈ ਹੋਈ ਸੀ ਉਸ ਕਲਾ ਨੂੰ ਵੇਖ ਕੇ ਮੇਰੇ ਦਿਲ ਵਿੱਚ ਕਲਾ ਕਰਨ ਦੀ ਦਿਲਚਸਪੀ ਉੱਠੀ ਇਸ ਤੋਂ ਬਾਅਦ ਮੈਨੇ ਕਲਾ ਕਰਨੀ ਸ਼ੁਰੂ ਕਰ ਦਿੱਤੀ ਉਹ ਬਹੁਤ ਹੀ ਸੁੰਦਰ ਕਲਾ ਸੀ ਉਸ ਕਲਾ ਨੂੰ ਦੇਖ ਕੇ ਮੇਰਾ ਦਿਲ ਬਹੁਤ ਹੀ ਖੁਸ਼ ਹੋਇਆ ਇਸ ਤੋਂ ਬਾਅਦ ਮੈਂ ਕਲਾ ਕਿਰਤੀ ਵਿੱਚ ਆਪਣੀ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਕਲਾ ਕਿਰਤੀ ਕਰਨੀ ਹੁਣ ਮੈਨੂੰ ਬਹੁਤ ਹੀ ਜ਼ਿਆਦਾ ਚੰਗੀ ਲੱਗਦੀ ਹੈ ਸ਼ੋਸ਼ਲ ਮੀਡੀਆ ਉੱਤੇ ਵੀ ਮੈਂ ਕਈ ਤਰ੍ਹਾਂ ਦੀਆਂ ਕਲਾ ਕਿਰਤੀਆਂ ਦੀਆਂ ਵੀਡੀਓ ਵੇਖੀਆਂ ਹਨ ਉਹਨਾਂ ਵਿੱਚ ਬਹੁਤ ਹੀ ਚੰਗੀ ਤਰ੍ਹਾਂ ਅਤੇ ਸੁਚੱਜੇ ਢੰਗ ਨਾਲ ਕਲਾ ਕਰਨੀ ਸਿਖਾਉਂਦੇ ਹੈ ਉਹ ਬਹੁਤ ਹੀ ਆਸਾਨੀ ਨਾਲ ਕਲਾ ਨੂੰ ਬਣਾਉਣਾ ਸਖਾਉਂਦੇ ਹਨ ਜਿਵੇਂ ਕਿ ਕਿਸੇ ਦਾ ਮੂੰਹ ਦੀ ਮੂੰਹ ਬਣਾਉਣਾ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਪੇਂਟਿੰਗ ਕਰਨੀ ਉਹ ਬਹੁਤ ਹੀ ਚੰਗੇ ਤਰੀਕੇ ਨਾਲ ਸਿਖਾਉਂਦੇ ਹਨ ਉਹ ਸਾਨੂੰ ਇਹ ਵੀ ਦੱਸਦੇ ਹਨ ਕਿ ਅਸੀਂ ਕਿਸ ਤਰ੍ਹਾਂ ਕਿਹੜਾ ਰੰਗ ਕਿਵੇਂ ਕਰ ਸਕਦੇ ਹਾਂ ਇਹ ਸਾਰੀ ਵੀਡੀਆ ਤੋਂ ਵੀ ਇਹ ਸਾਰੀ ਵੀਡੀਓਜ਼ ਤੋਂ ਵੀ ਮੈਨੂੰ ਬਹੁਤ ਸਾਰੀ ਕਲਾ ਕਿਰਤੀਆਂ ਕਰਨ ਦੀ ਦਿਲਚਸਪੀ ਹੋਈ ਹੈ ਅੱਜ ਹੁਣ ਜਦੋਂ ਵੀ ਮੈਨੂੰ ਟਾਈਮ ਲੱਗਦਾ ਹੈ ਤਾਂ ਮੈਂ ਕਲਾ ਜ਼ਰੂਰ ਬਣਾਉਂਦੀ ਆ ਕੁਝ ਨਾ ਕੁਝ ਚਿੱਤਰਕਾਰੀ ਜ਼ਰੂਰ ਬਣਾਉਂਦੀ ਹਾਂ ਚਿੱਤਰਕਾਰੀ ਬਣਾਉਣੀ ਹੁਣ ਮੈਨੂੰ ਚੰਗੀ ਲੱਗਦੀ ਹੈ ਮੈਂ ਜਦੋਂ ਵੀ ਘਰ ਦੇ ਕੰਮਾਂ ਤੋਂ ਮੈਨੂੰ ਜਦੋਂ ਵੀ ਟਾਈਮ ਮਿਲਦਾ ਹੈ ਤਾਂ ਮੈਂ ਆਪਣੀ ਡਰਾਇੰਗ ਫਾਈਲ ਚੱਕਦੀ ਹਾਂ ਤਾਂ ਕੁਛ ਨਾ ਕੁਛ ਚਿੱਤਰਕਾਰੀ ਬਣਾਉਣ ਲੱਗ ਜਾਂਦੀ ਹਾਂ ਜੋ ਮੇਰੇ ਦਿਲ ਨੂੰ ਚੰਗਾ ਲੱਗਦਾ ਹੈ ਸਾਰੇ ਦਿਨ ਵਿੱਚ ਮੈਂ ਜੋ ਵੀ ਸੋਚਦੀ ਜਾਂ ਕਰਦੀ ਹਾਂ ਮੈਂ ਉਹਨਾਂ ਦੀ ਵੀ ਚਿੱਤਰਕਾਰੀ ਬਣਾ ਦਿੰਦੀ ਹਾਂ